ਹਾਂਜੀ ਮੇਰੇ ਕੋਲ ਐੱਲ ਪੀ ਜੀ ਦਾ ਕਨੈਕਸ਼ਨ ਹੈ ਅਤੇ ਅੱਜ ਕੱਲ੍ਹ ਜਿਹੜੇ ਆਹ ਸਿਲੰਡਰ ਹੋ ਗਏ ਹਨ ਬਹੁਤ ਹੀ ਜ਼ਰੂਰੀ ਹੋ ਗਏ ਹਨ ਹਰ ਇੱਕ ਲਈ ਕੋਈ ਵੀ ਚੁੱਲ੍ਹਾ ਬਾਲ ਕੇ ਰਾਜ਼ੀ ਨਹੀਂ ਹੈਗਾ ਕੋਈ ਵੀ ਗਰਮੀ 'ਚ ਨਹੀਂ ਤਪ ਸਕਦਾ ਅਤੇ ਆਹ ਮੈਨੂੰ ਵੀ ਪਤਾ ਆ ਜਦੋਂ ਸਾਡੇ ਪੇਰੈਂਟਸ ਦਾ ਟਾਈਮ ਸੀਗਾ ਉਦੋਂ ਉਹ ਲੱਕੜਾ ਬਾਲ਼ ਕੇ ਹੀ ਆਪਣਾ ਗੁਜ਼ਾਰਾ ਕਰਦੇ ਸੀਗੇ ਬਟ ਅੱਜ ਕੱਲ੍ਹ ਐਦਾਂ ਦਾ ਕੁਛ ਵੀ ਨਹੀਂ ਹੈਗਾ ਹਰ ਕੋਈ ਬਹੁਤ ਇਜ਼ੀਲੀ ਫੈਸੀਲਟੀਜ਼ ਚਾਹੁੰਦਾ ਹੈ ਵੀ ਮੇਰਾ ਆਹ ਸੌਖਾ ਕੰਮ ਸਰ ਜੇ ਤਾਂ ਕਰਕੇ ਲੋਕ ਐੱਲ ਪੀ ਜੀ ਕਨੈਕਸ਼ਨ ਉਹ ਕਰਦੇ ਹਨ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਐੱਲ ਪੀ ਜੀ ਦੇ ਕਾਰਨ ਮੈਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਬੜਾ ਇਜ਼ੀਲੀ ਅਤੇ ਬੜੇ ਸੌਖੇ ਤਰੀਕੇ ਨਾਲ ਮੇਰੇ ਘਰ ਦੇ ਬਾਹਰ ਸਿਲੰਡਰ ਆਉਂਦਾ ਆ ਅਤੇ ਮੈਂ ਚੱਕ ਕੇ ਅੰਦਰ ਰੱਖਦੀ ਹਾਂ ਅਤੇ ਮੇਰਾ ਕੰਮ ਈਜ਼ੀ ਹੋ ਜਾਂਦਾ ਆ